ਖੇਤੀਬਾੜੀ ਬਾਰੇ ਸੁਝਾਅ ਆਉਣ ਵਾਲੀ ਪੀੜ੍ਹੀ ਨੂੰ ਆਰਗੈਨਿਕ ਜੈਵਿਕ ਖੇਤੀ ਨੂੰ ਵਧੇਰੇ ਅਪਣਾਉਣਾ ਚਾਹੀਦਾ ਹੈ ਅੱਜ ਕੱਲ ਖੇਤੀਬਾੜੀ ਕਾਫੀ ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਪਾ ਕੇ ਬਥੇਰੇ ਕਰਨ ਉਪਜ ਪੈਦਾ ਲੈਣ ਲਈ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ ਕੀਟਨਾਸ਼ਕ ਦਵਾਈਆਂ ਵਾਲੀਆਂ ਫਸਲਾਂ ਤਿਆਰ ਹੋਣ ਤੋਂ ਬਾਅਦ ਸਰੀਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਭਿਅੰਕਰ ਬਿਮਾਰੀਆਂ ਜਿਵੇਂ ਕੈਂਸਰ ਅਤੇ ਹੋਰ ਕਾਫੀ ਕਿਸਮ ਦੀਆਂ ਭਿਅੰਕਰ ਬਿਮਾਰੀਆਂ ਆਉਂਦੀਆਂ ਹਨ ਅਤੇ ਸਰੀਰ ਨੂੰ ਉਹਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਆਉਣ ਵਾਲੀ ਪੀੜ੍ਹੀ ਨੂੰ ਇਹੀ ਸੱਦਾ ਹੈ ਕਿ ਉਪਜਾਊ ਖੇਤੀ ਕਰਨ ਲਈ ਜੈਵਿਕ ਅਤੇ ਰਸਾਇਣਿਕ ਔਰਗੈਨਿਕ ਖਾਦਾਂ ਘੱਟ ਕਰਨੀਆਂ ਚਾਹੀਦੀਆਂ ਹਨ ਅਤੇ ਵਾਹਣ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੁਝ ਟਾਈਮ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਮਿੱਟੀ ਆਪਣੇ ਪੁਸ਼ ਦੁਬਾਰਾ ਪ੍ਰਾਪਤ ਕਰ ਸਕੇ ਅਤੇ ਫਸਲਾਂ ਦੀ ਕਟਾਈ ਕਰਨ ਤੋਂ ਬਾਅਦ ਵਾਹਣ ਦੇ ਵਿੱਚ ਕਦੇ ਵੀ ਅੱਗ ਨੂੰ ਨਹੀਂ ਲਗਾਉਣਾ ਚਾਹੀਦਾ ਉਸ ਨਾਲ ਖੇਤੀਬਾੜੀ ਦੇ ਵਾਹਣ ਵਿੱਚ ਉਪਜਾਊ ਤੱਤ ਮਰ ਜਾਂਦੇ ਹਨ ਇਸ ਕਰਕੇ ਖੇਤੀਬਾੜੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ